ਇਹਦੇ ਵਿੱਚ ਕੋਈ ਦੋਰਾਏ ਨਹੀਂ ਕਿ ਭਾਰਤ ਨਵੇਂ ਬਿਜਨਸਮੈਨ ਲਈ ਬਹੁਤ ਵੱਡੀ ਮੰਡੀ ਹੈ ਇਥੇ ਕੋਈ ਵੀ ਬਿਜ਼ਨਸ ਚੱਲ ਸਕਦਾ ਅਤੇ ਚੱਲ ਵੀ ਰਹੇ ਨੇ ਤੁਸੀਂ ਇਹਨਾਂ ਨੂੰ ਹੀ ਦੇਖ ਲਓ ਮੀਸ਼ੋ ਨੂੰ ਦੇਖ ਲਓ ਬਲਿੰਕ ਬਲਿੰਕਡ ਨੂੰ ਦੇਖ ਲਓ ਜਿਨਾਂ ਨੇ ਇੰਨੇ ਦੁਕਾਨਦਾਰ ਆ ਦੁਕਾਨਦਾਰਾਂ ਦਾ ਬਿਜ਼ਨਸ ਸੰਭਾਲਿਆ ਹੋਇਆ ਆ ਵੈਸੇ ਵੀ ਅੱਜ ਕੱਲ ਲੋਕ ਆਨਲਾਈਨ ਸ਼ਾਪਿੰਗ ਹੀ ਜ਼ਿਆਦਾ ਕਰਦੇ ਆ ਜਿਹਦੇ ਕਾਰਨ ਇੰਨੇ ਦੁਕਾਨਦਾਰਾਂ ਨੂੰ ਸਪੋਰਟ ਮਿਲਦੀ ਪਈ ਹੈ ਪਰ ਜੇ ਮੈਂ ਗੱਲ ਕਰਾਂ ਸਰਕਾਰ ਦੇ ਸਪੋਰਟ ਦੀ ਤਾਂ ਸਿਰਫ ਦੋ ਚਾਰ ਸਟੋਰ ਸਟੇਟ ਸੀ ਜਿਨਾਂ ਨੂੰ ਸਪੋਰਟ ਮਿਲਦੀ ਪਈ ਹ ਉਹਨਾਂ ਨੂੰ ਛੱਡ ਕੇ ਨਵੇਂ ਬਿਜਨਸ ਮੈਨ ਲਈ ਉਹ ਕੁਛ ਨਹੀਂ ਕਰਦੀਆਂ ਨਵੇਂ ਬਿਜਨਸ ਮੈਨ ਜਿੰਨੇ ਵੀ ਬੰਦ ਹੁੰਦੇ ਨੇ ਉਹਨਾਂ ਪਿੱਛੇ ਸਭ ਤੋਂ ਵੱਡਾ ਕਾਰਨ ਹੁੰਦਾ ਉਹਨਾਂ ਦੇ ਪੈਸੇ ਮਰਨਾ ਮਾਰਕੀਟ ਵਿੱਚ ਪੈਸੇ ਜੇ ਫਸ ਗਏ ਤਾਂ ਸਰਕਾਰ ਕੋਈ ਸਪੋਰਟ ਨਹੀਂ ਕਰਦੀ ਤੇ ਟੈਕਸ ਟਾਈਮ ਲਈ ਸਾਰੇ ਯਤਨ ਕਰ ਲੈਂਦੀਆਂ ਪਰ ਜੇ ਸਰਕਾਰ ਕੁਝ ਕਰੇ ਇਹਨਾਂ ਬਿਜ਼ਨਸ ਮੈਨ ਲਈ ਤਾਂ ਇੰਡੀਆ ਬਹੁਤ ਅੱਗੇ ਜਾ ਸਕਦਾ ਔਰ ਸਰਕਾਰ ਨੂੰ ਸਪੋਰਟ ਕਰਨੀ ਐ